ਟੈਕਨੋਲੋਜੀ ਅਤੇ ਇੰਟਰਨੈਟ ਦੇ ਵਿਕਾਸ ਨਾਲ ਪੰਜਾਬੀ ਭਾਸ਼ਾ ਵਿੱਚ ਕਈ ਤਬਦੀਲੀਆਂ ਆਈਆਂ ਹਨ ਇਹ ਨਵੇਂ ਸਾਧਨ ਅਤੇ ਸੰਚਾਰ ਵਿੱਚ ਵਰਤੇ ਜਾਣ ਦੇ ਤਰੀਕੇ ਨੂੰ ਪੰਜਾਬੀ ਭਾਸ਼ਾ ਨੇ ਅਨੁਸੂਚਿਤ ਕੀਤਾ ਹੈ ਇੰਟਰਨੈਟ ਦੇ ਅਗਾਲ ਨਾਲ ਹੀ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਨਵੇਂ ਸ਼ਬਦ ਅਤੇ ਤਕਨੀਕੀ ਅਦਾਂ ਦੀ ਵਰਤੋਂ ਸ਼ੁਰੂ ਹੋਈ ਹੈ ਇਹ ਭਾਸ਼ਾ ਪੰਜਾਬੀ ਭਾਸ਼ਾ ਦੇ ਵਰਗ ਪਦਾਰਥ ਨਾਲ ਵਰਤੋਂ ਕਰਨ ਵਾਲੇ ਲੋਕ ਹਵਾਲੇ ਤੋਂ ਬਦਲਿਆ ਹਾਂ ਜੋ ਉਹਨਾਂ ਦੇ ਜੀਵਨ ਵਿੱਚ ਤਕਨੀਕੀ ਮੁਕਾਬਲਿਆਂ ਨੂੰ ਨੁਕਸਾਨ ਕਰਦੇ ਹਨ ਪੰਜਾਬੀ ਭਾਸ਼ਾ ਵਿੱਚ ਸਾਹਿਤ ਅਤੇ ਮੀਡੀਆ ਵਿੱਚ ਵਰਤਾਏ ਜਾਣ ਵਾਲੇ ਟੈਕਨੋਲੋਜੀ ਨੂੰ ਅਪਡੇਟ ਕਰਨ ਵਾਲੇ ਨਵੇਂ ਸ਼ਬਦ ਅਤੇ ਸਮਰਥਨਾਂ ਨੂੰ ਨੁਕਸਾਨ ਕਰਨ ਲਈ ਹੋ ਗਏ ਹਨ ਇਹ ਤਬਦੀਲੀ ਨਾਲ ਹੀ ਪੰਜਾਬੀ ਭਾਸ਼ਾ ਨੂੰ ਅਧੂਰੀ ਭਾਸ਼ਾ ਵਜੋਂ ਨਹੀਂ ਚੁਣਿਆ ਜਾ ਸਕਦਾ ਬਲਕਿ ਇਹ ਇੱਕ ਜੀਵਨ ਸ਼ੈਲੀ ਅਤੇ ਸੋਧ ਦੇ ਰੂਪ ਵਿੱਚ ਵਧਣ ਦਾ ਸਾਧਨ ਹੈ